ਢੋਲ ਅਤੇ ਭੰਗੜੇ ਦਾ ਬਹੁਤ ਹੀ ਜ਼ਿਆਦਾ ਪੁਰਾਣੇ ਸਮੇਂ ਤੋਂ ਸੰਬੰਧ ਚੱਲਦਾ ਆ ਰਿਹਾ ਹੈ ਜੋ ਕਿ ਅੱਜ ਸਦੀਆਂ ਤੋਂ ਚੱਲਦਾ ਆ ਰਿਹਾ ਔਰ ਅੱਜ ਵੀ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ ਅਤੇ ਸ਼ੁਰੂ ਤੋਂ ਹੀ ਜਦੋਂ ਲੋਕ ਪੁਰਾਣੇ ਸਮੇਂ 'ਚ ਭੰਗੜਾ ਪਾਉਂਦੇ ਸੀ ਤਾਂ ਉਦੋਂ ਢੋਲ ਵੱਜਦਾ ਸੀ ਅਤੇ ਲੋਕ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਸੀ ਢੋਲ ਭੰਗੜਾ ਪਾਉਣ ਦੇ ਸਮੇਂ ਢੋਲ ਅਲਗੋਜੇ ਔਰ ਢੱਡ ਸਰੰਗੀ ਇਹ ਵਜਾਈਆਂ ਜਾਂਦੀਆਂ ਸੀ ਪੁਰਾਣੇ ਸਮਿਆਂ ਦੇ ਵਿੱਚ ਔਰ ਅੱਜ ਵੀ ਇਹ ਉਸ ਤਰੀਕੇ ਦੇ ਨਾਲ ਜਦੋਂ ਵੀ ਆਪਣੇ ਘਰ ਦੇ ਵਿੱਚ ਵਿਆਹ ਸ਼ਾਦੀ ਦਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਢੋਲ ਵਜਾਉਦੇ ਹਾਂ ਢੋਲ ਦੇ ਨਾਲ ਭੰਗੜਾ ਪੈਂਦਾ ਸਾਰੇ ਜਣੇ ਢੋਲ 'ਤੇ ਨੱਚਦੇ ਹਾਂ ਉਸ ਦੇ ਨਾਲ ਖੁਸ਼ੀ ਪ੍ਰਗਟ ਕਰਦੇ ਹਾਂ ਔਰ ਅੱਜ ਵੀ ਇਹ ਸਮਾਂ ਬਹੁਤ ਪ੍ਰਚਲਿਤ ਹੈ ਸਾਨੂੰ ਮਤਲਬ ਕਿ ਜਿਹੜੇ ਪੁਰਾਣੇ ਸੰਗੀਤਕਾਰ ਨੇ ਢੋਲ ਹੈ ਜਿਹੜਾ ਇਹ ਭੰਗੜੇ ਭੰਗੜਾ ਜਿਹੜਾ ਇਹ ਢੋਲ ਤੋਂ ਬਿਨਾਂ ਅਧੂਰਾ ਰਹਿ ਜਾਂਦਾ ਜਦੋਂ ਆਪਾਂ ਢੋਲ ਵੱਜਦਾ ਤਾਂ ਆਪਾਂ ਜਿੱਥੇ ਮਰਜ਼ੀ ਵੀ ਖੜ੍ਹੇ ਹੋ ਗਏ ਤਾਂ ਆਪਣੇ ਮੱਲੋ ਮੱਲੀ ਪੈਰ ਨੱਚਣ ਨੂੰ ਚੱਕੇ ਜਾਂਦੇ ਹਨ ਕੋਈ ਬਜ਼ੁਰਗ ਹੋਵੇ ਕੋਈ ਜਵਾਨ ਹੋਵੇ ਹਰ ਇੱਕ ਇਨਸਾਨ ਇਸ ਦੀ ਖੁਸ਼ੀ ਮਨਾਉਂਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਇਸ ਨੂੰ ਇੰਨਾ ਵਧੀਆ ਨੱਚਦੇ ਹਾਂ ਸਾਰੇ ਇਕੱਠੇ ਹੋ ਕੇ ਢੋਲ ਅਤੇ ਭੰਗੜੇ ਦਾ ਸੰਬੰਧ ਅੱਜ ਵੀ ਚੱਲਦਾ ਆ ਰਿਹਾ ਅੱਜ ਹੁਣ ਜਿੰਨੇ ਵੀ ਮਰਜ਼ੀ ਕੋਈ ਡੀ ਜੇ ਲਾ ਲਏ ਕੋਈ ਗੀਤ ਗਾ ਲਈਏ ਕੋਈ ਵੀ ਗਾਉਣ ਪਾਣੀ ਕਰ ਲਈਏ ਆਪਾਂ ਪਰ ਫਿਰ ਵੀ ਜਦੋਂ ਆਪਾਂ ਲਾਸਟ 'ਤੇ ਕਹਿੰਦੇ ਵੀ ਚਲੋ ਵੀ ਢੋਲ ਢੋਲ ਵਾਲਾ ਤਾਂ ਜ਼ਰੂਰ ਹੋਣਾ ਚਾਹੀਦਾ ਜਦੋਂ ਢੋਲ ਵਾਲਾ ਆਉਂਦਾ ਅਤੇ ਉਹ ਢੋਲ 'ਤੇ ਇੱਕ ਹੀ ਡੱਗਾ ਲਾਉਂਦਾ ਤਾਂ ਅਸੀਂ ਸਾਰੇ ਜਣੇ ਮਤਲਬ ਉਸ 'ਤੇ ਨੱਚਣਾ ਸ਼ੁਰੂ ਕਰ ਦਿੰਦੇ ਹਾਂ ਔਰ ਜਿਹੜੀ ਖੁਸ਼ੀ ਹੁੰਦੀ ਆ ਉਹ ਮਤਲਬ ਕਿ ਹੰਡਰਡ ਪ੍ਰਸੈਂਟ ਵੱਧ ਜਾਂਦੀ ਹੈ ਔਰ ਨੱਚਦੇ ਨੱਚਦੇ ਅਸੀਂ ਬਹੁਤ ਹੀ ਜਿਆਦਾ ਖੁਸ਼ੀ ਮਨਾਉਂਦੇ ਹਾਂ ਔਰ ਬਹੁਤ ਹੀ ਵਧੀਆ ਮਤਲਬ ਕਿ ਅਸੀਂ ਇਸ ਨੂੰ ਮਤਲਬ ਮਾਹੌਲ ਵਧੀਆ ਬਣ ਜਾਂਦਾ ਇਸ ਕਰਕੇ ਸਾਡਾ ਭੰਗੜੇ ਅਤੇ ਢੋਲ ਦਾ ਬਹੁਤ ਜ਼ਿਆਦਾ ਗਹਿਰਾ ਸੰਬੰਧ ਹੈ ਔਰ ਦੁਨੀਆ ਤੱਕ ਚੱਲਦਾ ਹੀ ਰਹੇਗਾ